ਹਾਂਜੀ ਹਾਂਜੀ ਹਾਂਜੀ ਹਾਂਜੀ ਪਾਲ ਢਾਬਾ ਜੀ ਹਾਂਜੀ ਵਧੀਆ ਢਾਬਾ ਏ ਦੱਸੋ ਕੀ ਨੋਲੇਜ ਲੈਣੀ ਹੈ ਉਹਦੇ ਬਾਰੇ ਖਾਣ ਪੀਣ ਹਾਂਜੀ ਘਰ ਦੀ ਤਰ੍ਹਾਂ ਖਾਣਾ ਪੀਣਾ ਮਿਲਦਾ ਜੀ ਫਰੈਸ਼ ਮਿਲੇਗਾ ਤੁਹਾਨੂੰ ਦਾਲ ਸਬਜ਼ੀ ਸਭ ਕੁਝ ਟੋਟਲੀ ਫਰੈਸ਼ ਹੁੰਦਾ ਏ ਜੀ ਇਹਨਾਂ ਕੋਲ ਇਸ ਤੋਂ ਇਲਾਵਾ ਤੁਸੀਂ ਪੈਕਿੰਗ ਪੈਕ ਵੀ ਕਰਵਾ ਸਕਦੇ ਹੈ ਡੇਲੀ ਹੋਮ ਡਿਲੀਵਰੀ ਵੀ ਕਰ ਦਿੰਦੇ ਹਾਂ ਜੀ ਹਾਂਜੀ ਚਿਕਨ ਵੀ ਹੈ ਮਟਨ ਵੀ ਹੈ ਸਭ ਕੁਝ ਬਣਾਉਂਦੇ ਹੈ ਜੀ ਵਧੀਆ ਬਣਾਉਂਦੇ ਯੈੱਸ ਸਾਰਾ ਕੁਝ ਹੀ ਫਰੈਸ਼ ਮਿਲੇਗਾ ਤੁਹਾਨੂੰ ਹਾਂਜੀ ਹਾਂਜੀ ਨੇੜੇ ਹੀ ਹਾਂ ਮੈਂ ਖਰੜ ਦੇ ਨਾਲ ਹੀ ਪੈ ਜਾਂਦਾ ਜੀ ਕੋਈ ਕੋਈ ਕੋਈ ਗੱਲ ਨਹੀਂ ਸਰ ਆਓ ਤੁਸੀਂ ਮੋਸਟ ਵੈਲਕਮ ਠੀਕ ਹੈ ਜੀ ਥੈਂਕ ਯੂ